ਸਵੇਰ ਨੂੰ ਸਾਝਰੇ ਉੱਠ ਕੇ ਮੈਂ ਨਹਾ ਕੇ ਮੱਥਾ ਟੇਕ ਕੇ ਡਾਇਟ ਲੈ ਕੇ ਮੈਂ ਰਨਿੰਗ ਕਰਨੀ ਸਟਾਰਟ ਕਰ ਦਿੰਦਾ ਹਾਂ ਮੈਂ ਘੱਟੋ ਘੱਟ ਛੇ ਸੱਤ ਕਿਲੋਮੀਟਰ ਰਨਿੰਗ ਕਰਕੇ ਐਕਸਰਸਾਈਜ ਕਰਕੇ ਫਿਰ ਗੇਮ ਖੇਡਣੀ ਸ਼ੁਰੂ ਕਰ ਦਿੰਦੇ ਹਾਂ ਜਾਂ ਕਬੱਡੀ ਜਾਂ ਵੋਲਬਾਲ ਜਾਂ ਫੁੱਟਬਾਲ ਕੁਛ ਵੀ ਖੇਡ ਕੇ ਫੇਰ ਘਰ ਜਾ ਕੇ ਰਿਲੈਕਸ ਕਰਕੇ ਪਸੀਨਾ ਆਪਣੇ ਨੂੰ ਸੁਕਾ ਕੇ ਉਹ ਕਰਕੇ ਫਿਰ ਨਹਾ ਕੇ ਫਿਰ ਘਰ ਦੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ ਨਾ ਇਹਦਾ ਟੀਚਾ ਵੀ ਮੈਂ ਇੱਕ ਇੰਟਰਨੈਸ਼ਨਲ ਪਲੇਅਰ ਇੰਟਰਨੈਸ਼ਨਲ ਪਲੇਅਰ ਬਣਨਾ ਚਾਹੁੰਦਾ ਹਾਂ ਮੈਂ ਬਈ ਦੌੜ ਦਾ ਰਿਕਾਰਡ ਪੈਦਾ ਕਰਨਾ ਚਾਹੁੰਦਾ ਕਿ ਹਾਂ ਮੈਂ ਇਹਦੇ 'ਚ ਐਨਾ ਵਧੀਆ ਸਭ ਤੋਂ ਉੱਚਾ ਲੈਵਲ ਤੋਂ ਹਾਂ ਵੀ ਮੈਂ ਵਧੀਆ ਹੋਵਾਂ ਇਹਦੇ ਵਿੱਚ ਕੀ ਹੁੰਦਾ ਵੀ ਪਿੰਡ ਦਾ ਨਾਮ ਰੋਸ਼ਨ ਹੋਊਗਾ ਵੀ ਹਾਂ ਸਾਡੇ ਪਿੰਡ ਦਾ ਮੁੰਡਾ ਰਨਿੰਗ 'ਚ ਫਸਟ ਆਇਆ ਇੰਟਰਨੈਸ਼ਨਲ ਖੇਡ ਕੇ ਆਇਆ ਇੰਟਰਨੈਸ਼ਨਲ ਰਨਿੰਗ ਕਰੀ ਵੀ ਸਭ ਤੋਂ ਸਾਨੂੰ ਇਹਦਾ ਬੈਨੀਫਿਟ ਇਹ ਹੁੰਦਾ ਵੀ ਹਾਂ ਜਦੋਂ ਉੱਠੋ ਸਵੇਰੇ ਦੋੜ ਲਾਓ ਐਕਸਰਸਾਈਜ਼ ਕਰੋ ਵੀ ਹੋਰ ਵੀ ਹਾਂ ਵੀ ਯਾਰ ਦੋਸਤ ਇਕੱਠੇ ਹੋ ਕੇ ਰਨਿੰਗ ਕਰੋ ਸਾਝਰੇ ਸਾਝਰੇ ਇੱਕ ਤਾਂ ਰਨਿੰਗ ਕਰਨ ਨਾਲ ਆਪਣੀ ਸਰੀਰ ਤੰਦਰੁਸਤ ਸਭ ਕੁਝ ਵਧੀਆ ਰਹਿੰਦਾ ਸਾਰਾ ਵਧੀਆ ਹੋਣ ਤੋਂ ਬਾਅਦ ਆਪਾਂ ਸਾਰੀ ਦਿਹਾੜੀ ਸਰੀਰ ਰਿਲੈਕਸ ਨਾ ਬੰਦੇ ਨੂੰ ਕੋਈ ਦੁੱਖ ਪਰੇਸ਼ਾਨੀ ਨਾ ਕੋਈ ਸਰੀਰ ਨੂੰ ਐਨੀ ਛੇਤੀ ਬਿਮਾਰੀ ਲੱਗਦੀ ਹੈ ਜਿੰਨਾ ਬੰਦਾ ਕੋਈ ਨਾ ਕੋਈ ਗੇਮ ਵੱਲ ਨੂੰ ਜਾਂ ਰਨਿੰਗ ਵੱਲ ਨੂੰ ਨਹੀਂ ਜਾਂਦਾ ਉਹ ਬਿਮਾਰ ਜਾਂ ਕੁਛ ਵੀ ਪਿਆ ਰਹਿੰਦਾ ਮੰਜੇ ਪਰ ਹਾਂ ਹੋਰ ਦਿਮਾਗੀ ਟੈਨਸ਼ਨਾਂ ਬਹੁਤ ਹਾਂ ਇੱਕ ਰਨਿੰਗ ਕਰੋ ਦੌੜ ਲਾਓ ਟੈਨਸ਼ਨ ਫਰੀ ਬੰਦੇ ਨੂੰ ਕੋਈ ਬਿਮਾਰੀ ਨਹੀਂ ਕੋਈ ਕੁਛ ਨਹੀਂ ਸਰੀਰ ਵੀ ਐਨ ਫਿਟ ਰਹਿੰਦਾ